ਹੈਲੋ ਹਾਂਜੀ ਸਰ ਨਮਸ਼ਕਾਰ ਜੀ ਨਮਸ਼ਕਾਰ ਕਿੱਥੋਂ ਦੀ ਸਰ ਬੈਂਗਲੋਰ ਜਾਣਾ ਠੀਕ ਹੈ ਸਰ ਅਤੇ ਕਿੱਥੋਂ ਕਿੱਥੋਂ ਜਾਣਾ ਸਰ ਤੁਸੀਂ ਫਾਜ਼ਿਲਕਾ ਤੋਂ ਬੈਂਗਲੋਰ ਠੀਕ ਹੈ ਸਰ ਕਰ ਦਾਂਗੇ ਸਰ ਆਪਣੇ ਟਾਈਮ ਤੁਸੀਂ ਕਿਹੜਾ ਲੈਣਾ ਸਰ ਇੱਥੋਂ ਸਰ ਆਪਣੇ ਕੋਲ ਤਿੰਨ ਤਿੰਨ ਟਾਈਮ ਹੈਗੇ ਹੈ ਸਰ ਇੱਕ ਦਸ ਵਜੇ ਦਾ ਹੈ ਸਰ ਅਤੇ ਦੂਜਾ ਟੈਮ ਹੈ ਜਿਹੜਾ ਉਹ ਹੈਗਾ ਹੈ ਦੋ ਵਜੇ ਦਾ ਅਤੇ ਇੱਕ ਸ਼ਾਮ ਦਾ ਹੈਗਾ ਸਰ ਉਹ ਹੈਗਾ ਹੈ ਸੱਤ ਵਜੇ ਦਾ ਹਾਂਜੀ ਸਰ ਆਪਾਂ ਨੂੰ ਨਾ ਇੱਕ ਇੱਕ ਟਰੇਨ ਬਦਲਨੀ ਪਏਗੀ ਅਤੇ ਓਸ ਤੋਂ ਬਾਅਦ ਸਿੱਧੀ ਜਾਏਗੀ ਸਰ ਹਾਂਜੀ ਹਾਂਜੀ ਸਰ ਹੋਜੇਗੀ ਜੀ ਬੁਕਿੰਗ ਸਲੀਪਰ ਸਲੀਪਰ ਚਾਹੀਦੀ ਹੈ ਠੀਕ ਹੈ ਸਰ ਉਹ ਵੀ ਕਰ ਦਾਂਗੇ ਸਰ ਬੁੱਕ ਕਰ ਦਾਂਗੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਇੱਕਦਮ ਵਧੀਆ ਜੀ ਹਾਂ ਉਹ ਸਰ ਵਿੱਚੇ ਹੁੰਦਾ ਸਭ ਕੁਛ ਵਧੀਆ ਹੁੰਦਾ ਹੈ ਹਾਂਜੀ ਫੁੱਲ ਏਸੀ ਹੋਏਗੀ ਸਰ ਏਸੀ ਕੋਚ ਏਸੀ ਕੋਚ 'ਚ ਕਰਾ ਦਿੰਦੇ ਹਾਂ ਸਰ ਤੁਹਾਡੀ ਬੁਕਿੰਗ

ਹਾਂਜੀ ਹਾਂਜੀ ਸਰ ਬਿਲਕੁਲ ਵਧੀਆ ਨਹੀਂ ਸਰ ਪੂਰੀ ਕੰਫਰਟੇਬਲ ਹੋਏਗੀ ਸਰ ਇੱਥੋਂ ਸਰ ਆਪਣਾ ਤਕ ਤਕਰੀ ਤਕਰੀਬਨ ਅਠਾਈ ਸੌ ਰੁਪਏ ਦੀ ਹੈਗੀ ਏ ਸਰ ਟਿਕਟ ਹਾਂਜੀ ਹਾਂਜੀ ਸਰ ਅਤੇ ਸਰ ਇੱਕ ਤੁਸੀਂ ਏ ਸਿੰਗਲ ਕਰਾਉਣੀ ਏ ਜਾਂ ਵਿੱਦ ਫੈਮਿਲੀ ਹੈਗੀ ਏ ਸਰ ਅੱਛਾ ਨਾਲ ਫੈਮਿਲੀ ਵੀ ਹਾਂ ਸਰ ਅੱਪ ਡਾਊਨ ਦੀ ਦੋਨਾਂ ਦੀ ਇਕੱਠੀ ਕਰ ਦਿੰਦੇ ਹਾਂ ਹਾਂ ਸਰ ਇਕੱਠੀ ਹੋ ਜੇਗੀ ਰਿਜਰਵੇਸ਼ਨ ਲੱਗ ਜੇਗੀ ਰਿਜਰਵ ਕਰ ਦਿੰਦੇ ਹਾਂ ਸੀਟ ਤੁਹਾਡੀ ਤੁਹਾਡਾ ਵਾਪਸੀ ਟੈਮ ਹੈਗਾ ਜਿਹੜਾ ਉਹ ਦੱਸ ਦਿਓ ਮੈਨੂੰ ਅਤੇ ਅੱਛਾ ਉਹ ਨੈਕਸਟ ਡੇਅ ਤੁਹਾਡਾ ਕਰ ਦਿੰਦੇ ਹਾਂ ਅਗਲੇ ਦਿਨ ਦਾ ਅਤੇ ਹਾਂਜੀ ਸਰ ਔਨਲਾਈਨ ਹੋ ਜੇਗੀ ਤੁਹਾਡੇ ਮੋਬਾਈਲ 'ਤੇ ਆਜੇਗਾ ਸਾਰਾ ਤੁਹਾਡੇ ਕੋਲ ਹਾਂ ਟਾਈਮ ਵਗੈਰਾ ਆਜੇਗਾ ਕਿੰਨੇ ਵਜੇ ਚੱਲੇਗੀ ਗੱਡੀ ਕਿੰਨੇ ਵਜੇ ਉੱਥੇ ਪਹੁੰਚੇਗੀ ਪ੍ਰੋਪਰ ਟਾਈਮ

ਹਾਂਜੀ ਹਾਂਜੀ ਹਾਂ ਨਹੀਂ ਸਰ ਕੋਈ ਦਿੱਕਤ ਨਹੀਂ ਆਏਗੀ ਸਰ ਮਿਲ ਜੇਗੀ ਓਕੇ ਓਕੇ ਹਾਂਜੀ ਹਾਂਜੀ ਹਾਂਜੀ ਓਕੇ ਸਰ ਹਾਂਜੀ ਹਾਂਜੀ ਓਕੇ ਸਰ ਓਕੇ